ਸਾਡੇ ਅਨੁਸਾਰ ਪੰਜਾਬੀ ਭੰਗੜੇ ਵਿੱਚ ਜਿਹੜਾ ਸੰਗੀਤ ਹੈ ਬਹੁਤ ਹੀ ਵਧੀਆ ਰੋਲ ਨਿਭਾਉਂਦਾ ਐਰੋਬਿਕਸ ਬਣਾਉਣ ਦੇ ਲਈ ਕਿਉਂਕਿ ਜਦੋਂ ਵੀ ਭੰਗੜਾ ਆਪਾਂ ਕਰਦੇ ਹਾਂ ਐਰੋਬਿਕਸ ਦੇ ਵਿੱਚ ਉਸ ਵੇਲੇ ਸਾਡੇ ਬੋਡੀ ਦੇ ਸਾਰੇ ਪਾਰਟ ਜਿਹੜੇ ਮਸਕੂਲਰ ਬੋਡੀ ਨਾ ਸਾਰੇ ਮਤਲਬ ਕਿ ਯੂਸ ਹੁੰਦੇ ਆ ਜਿਸ ਕਰਕੇ ਇਹ ਸਾਡੇ ਜ਼ਿੰਦਗੀ ਵਿੱਚ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਥਾਂ ਰੱਖਦੇ ਨੇ ਖ਼ਾਸ ਸੰਗੀਤ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ ਜਿਵੇਂ ਆਪਾਂ ਭੰਗੜੇ ਦੇ ਵਿੱਚ ਢੋਲ ਦੀ ਬਹੁਤ ਵਧੀਆ ਵਰਤੋਂ ਕਰ ਸਕਦੇ ਜਦੋਂ ਆਪਾਂ ਢੋਲ ਵੱਜਿਆ ਵੱਜਦਾ ਹੋਵੇ ਤਾਂ ਉੱਥੇ ਹਰ ਤਰ੍ਹਾਂ ਦੇ ਲੋਕ ਲਾਗੇ ਛਾਗੇ ਜਿੰਨੇ ਵੀ ਸੁਣਦੇ ਹੋਣਗੇ ਉਹ ਖੜੇ ਨਹੀਂ ਰਹਿ ਸਕਦੇ ਉਹ ਭੰਗੜਾ ਜ਼ਰੂਰ ਪਾਣਗੇ ਇਸ ਕਰਕੇ ਭੰਗੜੇ ਵਿੱਚ ਐਰੋਬਿਕਸ ਦਾ ਬਹੁਤ ਵੱਡਾ ਹੱਥ ਹੈ ਬਹੁਤ ਵੱਡਾ ਰੋਲ ਹੈ ਕਿਉਂਕਿ ਉਹ ਭੰਗੜਾ ਕਰਨ ਵਾਲਾ ਬੰਦਾ ਕਦੇ ਵੀ ਮਤਲਬ ਕਿ ਪਰਟੀਕਲਰ ਇੱਕ ਪਾਰਟ 'ਚ ਨਹੀਂ ਖੜਾ ਹੋ ਸਕਦਾ ਇੱਕ ਥਾਂ 'ਚ ਇੱਕ ਪੁਜ਼ੀਸ਼ਨ 'ਚ ਹੋਲਡ ਆਪਣੇ ਆਪ ਨੂੰ ਨਹੀਂ ਕਰ ਸਕਦਾ ਉਹ ਬਹੁਤ ਜ਼ਿਆਦਾ ਮੂਮੈਂਟਸ ਕਰਦਾ ਹੈ ਬਹੁਤ ਜ਼ਿਆਦਾ ਥਾਂ ਨੂੰ ਬਦਲਦਾ ਹੈ ਜਿਸ ਕਰਕੇ ਭੰਗੜਾ ਇੱਕ ਬਹੁਤ ਹੀ ਵ ਵਧੀਆ ਐਰੋਬਿਕਸ ਹੈ ਅਤੇ ਇਹਦੇ ਨਾਲ ਹੀ ਸੰਗੀਤ ਤੋਂ ਵਗੈਰ ਤਾਂ ਐਰੋਬਿਕਸ ਪੋਸੀਬਲ ਨਹੀਂ ਹੈ ਭੰਗੜੇ ਵਿੱਚ ਸਪੈਸ਼ਲੀ ਸੋ ਇਸ ਵਾਸਤੇ ਆਪਾਂ ਜੋ ਹੈ ਵੀ ਢੋਲ ਦੀ ਵਰਤੋਂ ਕਰਦੇ ਹਾਂ